ਮੈਨੂੰ ਵੀ ਸਾਡੇ ਪਰਿਵਾਰ ਵਿੱਚ ਬਾਗਬਾਨੀ ਦਾ ਬਹੁਤ ਸ਼ੌਂਕ ਹੈ ਇਸ ਮੇਰੇ ਤੋਂ ਇਲਾਵਾ ਮੇਰੇ ਪਰਿਵਾਰ ਵਿੱਚ ਮੇਰੀ ਮੰਮੀ ਵੀ ਬਹੁਤ ਸ਼ੌਂਕ ਰੱਖਦੇ ਸੀ ਉਹਨਾਂ ਨੂੰ ਵੀ ਬਾਗਬਾਨੀ ਵਿੱਚ ਬਹੁਤ ਇੰਟਰਸਟ ਸੀ ਉਹ ਫਰੂਟਸ ਦੇ ਦਰੱ ਬੂਟੇ ਵੀ ਲਗਾਉਂਦੇ ਸੀਗੇ ਫੁੱਲਾਂ ਦੇ ਬੂਟਿਆਂ 'ਚ ਵੀ ਉਹਨਾਂ ਨੂੰ ਇੰਟਰਸਟ ਸੀਗਾ ਇਸ ਤੋਂ ਇਲਾਵਾ ਉਹਨਾਂ ਨੂੰ ਜੋ ਵੀ ਬੂਟਾ ਜੇ ਕਿਤੇ ਉਹ ਕੋਈ ਹੋਰ ਫੁੱਲ ਵਾਲਾ ਬੂਟਾ ਜਾਂ ਫਰੂਟਸ ਵਾਲਾ ਬੂਟਾ ਲੱਗਿਆ ਦੇਖਦੇ ਤਾਂ ਉਹਦੇ ਨਾਲ ਦਾ ਕਿਤੋਂ ਨਰਸਰੀ ਚੌਂ ਲਾਗਿਓਂ ਲੈ ਕੇ ਜ਼ਰੂਰ ਆਉਂਦੇ ਸੀਗੇ ਅਤੇ ਉਹ ਉਹਨਾਂ ਦੀ ਦੇਖਭਾਲ ਵੀ ਬਹੁਤ ਕਰਦੇ ਆ ਉਹਨਾਂ ਨੂੰ ਗੋਡੀ ਪਾਉਣੀ ਮੈਂ ਵੀ ਉਹਨਾਂ ਦੀ ਮਦਦ ਕਰਦੀ ਉਹ ਵੀ ਮੇਰੀ ਮਦਦ ਕਰਦੇ ਉਹਨਾਂ ਨੂੰ ਗੋਡੀ ਪਾਉਣੀ ਉਹਨਾਂ ਨੂੰ ਰੇਹ ਪਾਉਣੀ ਉਹਨਾਂ ਦੀ ਪਾਣੀ ਲਗਾਉਣਾ ਉਹਨਾਂ ਨੂੰ ਅਤੇ ਉਹਨਾਂ ਦੀ ਅੱਗੇ ਹੋਰ ਦੇਖਭਾਲ ਕਰਨੀ ਇਹਦੇ ਵਿੱਚ ਬਹੁਤ ਇੰਟਰਸਟ ਰੱਖਦੇ ਸੀ ਮੰਮੀ ਦੇ ਸ਼ੌਂਕ ਨਾਲ ਹੀ ਇਹ ਸ਼ੌਂਕ ਮੈਨੂੰ ਮੰਮੀ ਤੋਂ ਹੀ ਮਿਲਿਆ ਅਤੇ ਮੰਮੀ ਦੇ ਸ਼ੌਂਕ ਨਾਲ ਹੀ ਇਹ ਮੇਰਾ ਸ਼ੌਂਕ ਅੱਗੇ ਵਧਿਆ ਅਤੇ ਇਹ ਬਹੁਤ ਵਧੀਆ ਲੱਗਦਾ ਗਾ ਜਦੋਂ ਤਰ੍ਹਾਂ ਤਰ੍ਹਾਂ ਦੇ ਫੁੱਲਾਂ 'ਚ ਜਾਂ ਤਰ੍ਹਾਂ ਤਰ੍ਹਾਂ ਦੀ ਫਲਾਂ 'ਚ ਜਾਂਦੇ ਹੈਗੇ ਅਤੇ ਦੇਖਦੇ ਹਾਂ ਲੱਗੇ ਤਾਂ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈਗੀ ਅਤੇ ਇਹ ਇੱਕ ਵਧੀਆ ਵਾਤਾਵਰਨ ਵੀ ਦਿੰਦੇ ਆਪਾਂ ਨੂੰ ਜੇ ਆਪਣੇ 'ਚ ਜਿਹੜੀ ਆਕਸੀਜਨ ਦੀ ਘਾਟ ਆ ਜਿਹੜੀ ਆਪਣੇ ਆਲੇ ਦੁਆਲੇ ਇਹ ਉਹਨੂੰ ਵੀ ਪੂਰੀ ਕਰਦੇ ਹੈਗੇ ਅਤੇ ਆਪਣਾ ਜੇ ਕਈ ਵਾਰ ਆਪਣਾ ਮਨ ਉਦਾਸ ਹੋਵੇ ਤਾਂ ਜਦੋਂ ਆਪਾਂ ਫੁੱਲ ਬੂਟਿਆਂ 'ਚ ਜਾਂਦੇ ਹੈਗੇ ਤਾਂ ਬਾਗਾਂ 'ਚ ਜਾਂਦੇ ਹਾਂ ਅਤੇ ਆਪਣਾ ਮਨ ਬਦਲ ਜਾਂਦਾ ਗਾ ਅਤੇ ਆਪਾਂ ਨੂੰ ਵਧੀਆ ਲੱਗਦਾ ਗਾ ਇਸ ਚੀਜ਼ ਨਾਲ ਇੰਟਰਸਟ ਜੁੜਦਾ ਗਾ ਅਤੇ ਇਸ ਕਰਕੇ ਮੈਨੂੰ ਅਤੇ ਮੇਰੀ ਮੰਮੀ ਨੂੰ ਦੋਨਾਂ ਨੂੰ ਹੀ ਜ਼ਿਆਦਾ ਸ਼ੌਂਕ ਆ ਜੀ